ਸਤਿ ਸ਼੍ਰੀ ਅਕਾਲ ਸਰ ਓਲਾ ਕੰਪਨੀ ਤੋਂ ਬੋਲਦੇ ਮੈਂ ਆਪ ਦੀ ਵੈੱਬਸਾਈਟ ਤੋਂ ਆਪਦਾ ਨੰਬਰ ਲਿਆ ਹੈ ਮੈਂ ਆਪ ਨਾਲ ਕੈਬ ਦੀ ਬੁਕਿੰਗ ਦੇ ਅਧਾਰ 'ਤੇ ਗੱਲ ਕਰਨਾ ਚਾਹੁੰਦੀ ਹਾਂ ਮੈਂ ਆਪਦੀ ਵੱਡੀ ਅਤੇ ਛੋਟੀ ਕੈਬ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀ ਹਾਂ ਮੈਂ ਜਾਣਦਾ ਚਾਹੁੰਦੀ ਹਾਂ ਕਿ ਜੇਕਰ ਚਾਰ ਮੈਂਬਰਾਂ ਨਾਲ ਸੰਬੰਧਿਤ ਕੈਬ ਬੁੱਕ ਕਰਨੀ ਹੋਵੇ ਤਾਂ ਉਸਦੀ ਕੀ ਕੀਮਤ ਹੈ ਅਤੇ ਜੇਕਰ ਛੇ ਮੈਂਬਰਾਂ ਦੇ ਹਿਸਾਬ ਨਾਲ ਕੈਬ ਬੁੱਕ ਕਰਨੀ ਹੋਵੇ ਤਾਂ ਉਸਦੀ ਕੀ ਕੀਮਤ ਹੈ ਦਰਅਸਲ ਸਾਡਾ ਪਰਿਵਾਰ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਹੈ ਅਸੀਂ ਜਾਣਨਾ ਚਾਹੁੰਦੇ ਆਂ ਕਿ ਸ਼ਿਮਲੇ ਤੱਕ ਜਾਣ ਲਈ ਆਪ ਦੀ ਕੈਬ ਦਾ ਕੀ ਖਰਚ ਹੈ ਅਗਰ ਅਸੀਂ ਚਾਰ ਮੈਂਬਰਾਂ ਦੇ ਹਿਸਾਬ ਨਾਲ ਕੈਬ ਕਰਾਂਗੇ ਤਾਂ ਸਾਨੂੰ ਕਿੰਨਾ ਖਰਚਾ ਪਵੇਗਾ ਅਤੇ ਜੇਕਰ ਅਸੀਂ ਛੇ ਮੈਂਬਰਾਂ ਦੇ ਹਿਸਾਬ ਨਾਲ ਕੈਬ ਬੁੱਕ ਕਰਾਂਗੇ ਤਾਂ ਸਾਨੂੰ ਕੀ ਖਰਚਾ ਪਵੇਗਾ ਨਾਲ ਦੀ ਨਾਲ ਸਾਨੂੰ ਇਹ ਵੀ ਦੱਸੋ ਕਿ ਕਿੰਨੇ ਮੈਂਬਰ ਕਿਹੜੀ ਕੈਬ ਦੇ ਵਿੱਚ ਆਸਾਨੀ ਨਾਲ ਬੈਠ ਕੇ ਜਾ ਸਕਦੇ ਨੇ ਜੇਕਰ ਚਾਰ ਮੈਂਬਰਾਂ ਵਾਲੀ ਕੈਬ ਕਰਾਂਗੇ ਤਾਂ ਕੀ ਉਸ ਵਿੱਚ ਛੇ ਮੈਂਬਰ ਆਸਾਨੀ ਨਾਲ ਬੈਠ ਕੇ ਜਾ ਸਕਦੇ ਹਨ ਜੇਕਰ ਨਹੀਂ ਤਾਂ ਫਿਰ ਤੁਸੀਂ ਸਾਨੂੰ ਛੇ ਮੈਂਬਰਾਂ ਵਾਲੀ ਕੈਬ ਦੀ ਕੀਮਤ ਵੀ ਪੂਰੀ ਜਾਣਕਾਰੀ ਦਿਓ ਆਪ ਦੀ ਦਿੱਤੀ ਜਾਣਕਾਰੀ ਅਤੇ ਖਰਚੇ ਦੇ ਅਧਾਰ 'ਤੇ ਹੀ ਅਸੀਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਲਾਹ ਕਰਕੇ ਜਾਣ ਦਾ ਪ੍ਰੋਗਰਾਮ ਬਣਾਵਾਂਗੇ ਕਿ ਅਸੀਂ ਚਾਰ ਮੈਂਬਰਾਂ ਨੇ ਜਾਣਾ ਹੈ ਕਿ ਛੇ ਉਸਦੇ ਅਧਾਰ 'ਤੇ ਹੀ ਕੈਬ ਬੁੱਕ ਕਰਾਂਗੇ ਆਪਦੇ ਦੱਸੇ ਖਰਚੇ ਦੇ ਅਧਾਰ 'ਤੇ ਹੀ ਅਸੀਂ ਕੈਬ ਬੁੱਕ ਕਰਾਂਗੇ ਸੋ ਮੇਰੀ ਆਪ ਅੱਗੇ ਬੇਨਤੀ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਆਪ ਵੱਡੀ ਅਤੇ ਛੋਟੀ ਦੋਨੋਂ ਕੈਬ ਦੀਆਂ ਕੀਮਤਾਂ ਦੀ ਜਾਣਕਾਰੀ ਦਿਓ ਧੰਨਵਾਦ